ਭਾਰਤ 'ਚ ਡਾਂਸਰਾ ਅਤੇ ਬਾਲੀਵੁੱਡ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ ਡਾਂਸ ਲੋਕਾਂ ਦੇ ਦਿਲਾਂ ਨੂੰ ਜਿੱਤਦਾ ਹੈ ਬੋਲੀਵੁੱਡ ਮੰਨੋਰੰਜਨ ਅਤੇ ਹਾਸਿਆਂ ਦਾ ਪਿਟਾਰਾ ਹੈ ਪੰਜਾਬੀ ਲੋਕ ਗੀਤ ਭਾਰਤ ਵਿੱਚ ਹਰ ਰਾਜ ਜਾਤੀ ਧਰਮਾਂ ਅਤੇ ਸਭ ਲੋਕਾਂ ਨੂੰ ਪਸੰਦ ਹੁੰਦੇ ਹਨ ਅਤੇ ਹਰਮਨ ਪਿਆਰੇ ਹਨ ਪੰਜਾਬ ਪੰਜਾਬੀ ਗੀਤਾਂ ਨੂੰ ਸਾਰੇ ਲੋਕਾਂ ਦੁਆਰਾ ਬਹੁਤ ਪਿਆਰ ਅਤੇ ਸਤਿਕਾਰ ਮਿਲਦਾ ਹੈ ਪੰਜਾਬੀ ਗੀਤਾਂ ਵਿੱਚ ਪੰਜਾਬੀਆਂ ਦਾ ਭਾਈਚਾਰਾ ਅਤੇ ਸੱਭਿਆਚਾਰ ਦਿਖਾਇਆ ਜਾਂਦਾ ਹੈ ਜਿਸ ਨੂੰ ਪੂਰੀ ਦੁਨੀਆ ਦਾ ਪਿਆਰ ਮਿਲਦਾ ਹੈ ਅਤੇ ਸਾਰੇ ਲੋਕ ਇਸਦਾ ਸਤਿਕਾਰ ਕਰਦੇ ਹਨ ਪੰਜਾਬੀ ਮੁੰਡੇ ਭੰਗੜਾ ਅਤੇ ਕੁੜੀਆਂ ਦੇ ਗਿੱਧੇ ਦੀ ਚਰਚਾ ਤਾਂ ਪੂਰੀ ਦੁਨੀਆ ਵਿੱਚ ਹੁੰਦੀ ਹੈ ਜਦੋਂ ਪੰਜਾਬੀ ਮੁੰਡੇ ਅਤੇ ਕੁੜੀਆਂ ਰਲ ਕੇ ਗਿੱਧਾ ਪਾਉਂਦੇ ਹਨ ਅਤੇ ਭੰਗੜਾ ਕਰਦੇ ਹਨ ਤਾਂ ਇਸ ਵਿੱਚ ਇੱਕ ਜਿਊਂਦਾ ਜਾਗਦਾ ਪੰਜਾਬ ਨਜ਼ਰ ਆਉਂਦਾ ਹੈ ਪੂਰੀ ਦੁਨੀਆ ਪੰਜਾਬੀ ਗੀਤਾਂ ਅਤੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਈਚਾਰੇ ਨੂੰ ਬਹੁਤ ਪਿਆਰ ਕਰਦੀ ਹੈ ਸਤਿਕਾਰ ਦਿੰਦੀ ਹੈ ਪੰਜਾਬੀ ਲੋਕ ਗੀਤ ਪੰਜਾਬੀ ਮੁੰਡੇ ਕੁੜੀਆਂ ਦਾ ਗਿੱਧਾ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਈਚਾਰਾ ਪੂਰੀ ਦੁਨੀਆ ਦੇ ਦਿਲਾਂ 'ਤੇ ਰਾਜ ਕਰਦਾ ਹੈ ਪੰਜਾਬੀ ਗੀਤਾਂ ਅਤੇ ਪੰਜਾਬੀ ਸੱਭਿਆਚਾਰ ਦੀ ਬੋਲ ਦੀ ਚਰਚਾ ਤਾਂ ਬੋਲੀਵੁੱਡ ਵਿੱਚ ਵੀ ਬਹੁਤ ਜ਼ਿਆਦਾ ਹੈ ਬੋਲੀਵੁੱਡ ਵਿੱਚ ਵੀ ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ ਦਿੱਤਾ ਜਾਂਦਾ ਹੈ